ਸਤਿ ਸ਼੍ਰੀ ਅਕਾਲ ਮੈਮ ਵ ਵਧੀਆ ਜੀ ਤੁਸੀਂ ਸੁਣਾਓ ਜੀ ਹਾਂਜੀ ਮੈਂ ਕਿਹਾ ਆਪਣਾ ਇਸ ਵੀਕ ਦੇ ਵਿੱਚ ਪੰਜ ਲੈਸਨ ਪਲੈਨ ਬਣਾ ਲਈਏ ਤੁਸੀਂ ਦੱ ਅੱਛਾ ਜੀ ਅਤੇ ਫਿਰ ਤੁਸੀਂ ਦੱਸ ਦਿਓ ਕਿੰਨੇ ਬਣਾਈਏ ਅੱਛਾ ਜੀ ਅਤੇ ਇਸ ਵੀਕ ਵਾਸਤੇ ਬਹੁਤ ਨੇ ਇਸ ਵੀਕ ਵਾਸਤੇ ਤਿੰਨ ਬਹੁਤ ਨੇ ਉਹ ਆਹੋ ਇਹ ਆਹੋ ਇਹ ਤਾਂ ਗੱਲ ਹੈਗੀ ਤੁਹਾਡੀ ਬੱਚੇ ਵੀ ਥੋੜ੍ਹੇ ਵੀਕ ਨੇ ਨਾ ਵੀ ਚਲੋ ਜੀ ਕਵਰ ਕਰ ਲੈਣਗੇ ਠੀਕ ਹੈ ਜੀ ਠੀਕ ਹੈ ਓ ਓਕੇ ਜੀ ਸਤਿ ਸ਼੍ਰੀ ਅਕਾਲ ਜੀ